ਚਿੱਤਰਕਾਰੀ ਲੋਕਾਂ ਲਈ ਬਹੁਤ ਜ਼ਿਆਦਾ ਲਾਭਕਾਰੀ ਹੋ ਸਕਦੀ ਹੈ ਜਿਵੇਂ ਕਿ ਚਿੱਤਰਕਾਰੀ ਵਿੱਚ ਮਨੁੱਖ ਦੇ ਮਨੋਭਾਵਾਂ ਨੂੰ ਪ੍ਰਗਟਾਇਆ ਜਾ ਸਕਦਾ ਹੈ ਬੱਚਿਆਂ ਨੂੰ ਅਨੁਸ਼ਾਸ਼ਨ ਵਿੱਚ ਰੱਖਿਆ ਜਾ ਸਕਦਾ ਹੈ ਚਿੱਤਰਕਾਰੀ ਨੂੰ ਕਰਦੇ ਸਮੇਂ ਅਨੁਸ਼ਾਸ਼ਨ ਵਿੱਚ ਰਹਿ ਕੇ ਅਤੇ ਇੱਕ ਸੰਗਠਿਤ ਬੱਚਿਆਂ ਨੂੰ ਕਰਕੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਿਆ ਜਾ ਸਕਦਾ ਹੈ ਇਸ ਤੋਂ ਬਹੁਤ ਸਾਰੀਆਂ ਰਚਨਾਵਾਂ ਦਾ ਵੀ ਰਚਨਾਵਾਂ ਦਾ ਹੁਨਰ ਪੈਦਾ ਹੁੰਦਾ ਹੈ ਚਿੱਤਰਕਾਰੀ ਨਾਲ ਲੋਕ ਆਪਣੇ ਅੰਦਰ ਛੁਪੀ ਕਲਾ ਨੂੰ ਬਾਹਰ ਕੱਢਦੇ ਹਨ ਜਿਸ ਨਾਲ ਉਹ ਆਪਣੀ ਕਲਪਨਾ ਨੂੰ ਸਾਬਿਤ ਕਰਦੇ ਹਨ ਅਤੇ ਭਰੋਸੇਯੋਗ ਬਣਾਉਂਦੇ ਹਨ ਇਸ ਵਿੱਚ ਬੱਚੇ ਜਵਾਨ ਕਿਸੇ ਵੀ ਉਮਰ ਦੇ ਵਿਅਕਤੀ ਚਿੱਤਰਕਾਰੀ ਨੂੰ ਕਰ ਸਕਦੇ ਹਨ